ਸਤਿ ਸ਼੍ਰੀ ਅਕਾਲ ਜੀ ਮੇਰੇ ਖਿਆਲ ਵਿੱਚ ਖੇਡਾਂ ਇੱਕ ਸਿਹਤਮੰਦ ਜੀਵਨ ਸ਼ੈਲੀ ਵਿੱਚ ਬੜਾ ਹੀ ਵੱਡਾ ਯੋਗਦਾਨ ਪਾਉਂਦੀਆਂ ਹਨ ਇਸ ਨਾਲ ਸਾਡਾ ਸਰੀਰਿਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ ਖੇਡਾਂ ਸਾਡੇ ਜੀਵਨ ਲਈ ਬਹੁਤ ਹੀ ਜ਼ਰੂਰੀ ਹਨ ਇਸ ਨਾਲ ਸਾਨੂੰ ਕਈ ਤਰ੍ਹਾਂ ਦੇ ਗੁਣ ਆਉਂਦੇ ਹਨ ਜਿੱਦਾਂ ਏਕਤਾ ਵਿੱਚ ਰਹਿਣਾ ਰਲ ਮਿਲ ਕੇ ਰਹਿਣਾ ਅਤੇ ਇੱਕ ਬਲ ਹੋ ਕੇ ਕੰਮ ਕਰਨਾ ਆਦਿ ਹੋਰ ਤਰ੍ਹਾਂ ਦੇ ਗੁਣ ਆਉਂਦੇ ਹਨ ਇਹ ਸਾਡੇ ਜੀਵਨ ਦੇ ਆਰੰਭ ਤੋਂ ਹੀ ਸ਼ੁਰੂ ਹੋ ਜਾਂਦੀਆਂ ਹਨ ਜਿੱਦਾਂ ਕਿ ਬਚਪਨ ਵਿੱਚ ਬੱਚਾ ਲੱਤਾ ਬਾਹਵਾਂ ਮਾਰਦਾ ਹੈ ਅਤੇ ਅਸੀਂ ਕਹਿੰਦੇ ਹਾਂ ਕਿ ਉਹ ਖੇਡ ਰਿਹਾ ਹੈ ਅਸੀਂ ਇਸ ਨੂੰ ਖੇਡਾਂ ਦਾ ਨਾਮ ਦਿੰਦੇ ਹਨ ਇਸ ਲਈ ਇਹ ਸਾਡੇ ਬਚਪਨ ਤੋਂ ਹੀ ਸਾਡੇ ਸ਼ੁਰੂ ਸਾਡੇ ਨਾਲ ਸ਼ੁਰੂ ਹੋ ਜਾਂਦੀਆਂ ਹਨ ਇਸ ਨਾਲ ਸਾਡੇ ਕਈ ਤਰ੍ਹਾਂ ਦੇ ਵਿਕਾਸ ਹੁੰਦੇ ਹਨ ਜੇ ਅਸੀਂ ਸਵੇਰ ਦੇ ਵਿੱਚ ਭੱਜੀਏ ਤਾਂ ਸਾਡਾ ਦਿਨ ਤਰੋ ਤਾਜ਼ਾ ਅਤੇ ਖਿੜਿਆ ਖਿੜਿਆ ਰਹਿੰਦਾ ਹੈ ਸਾਡੇ ਚਿਹਰੇ ਉੱਤੇ ਵੀ ਖੁਸ਼ੀ ਹੁੰਦੀ ਹੈ ਅਤੇ ਸਾਡਾ ਦਿਨ ਵੀ ਚੰਗਾ ਲੰਘਦਾ ਹੈ ਖੇਡਾਂ ਨਾਲ ਸਾਡੇ ਬਹੁਤ ਵਧੀਆ ਵਿਕਾਸ ਹੁੰਦਾ ਹੈ ਸਾਨੂੰ ਖੇਡਾਂ ਜ਼ਰੂਰ ਖੇਡਣੀਆਂ ਚਾਹੀਦੀਆਂ ਹਨ ਅਤੇ ਇਹ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹਨ ਇਸ ਨਾਲ ਅਸੀਂ ਤੰਦਰੁਸਤ ਰਹਿੰਦੇ ਹਾਂ ਅਤੇ ਸਾਡੇ ਸਰੀਰ ਵਿੱਚ ਮੋਟਾਪਾ ਵੀ ਨਹੀਂ ਆਉਂਦਾ ਧੰਨਵਾਦ